ਹਾਂਜੀ ਟਿਊਬਵੈੱਲ ਦੇ ਉੱਤੇ ਪੁਲ਼ੀ ਲੱਗੀ ਹੁੰਦੀ ਹੈ ਪੁਲ਼ੀ ਦੇ ਪੁਲ਼ੀ ਦਾ ਕੰਮ ਇਹ ਹੈ ਵੀ ਜਦੋਂ ਮਤਲਬ ਪੁਲ਼ੀ ਘੁੰਮਦੀ ਹੈ ਤਾਂ ਮਤਲਬ ਟਿੱਕੀ ਰਾਹੀਂ ਮਤਲਬ ਪਾਣੀ ਚੱਕ ਹੁੰਦਾ ਅਤੇ ਆਪਾਂ ਜਿਵੇਂ ਖੇਤਾਂ ਦੇ ਵਿੱਚ ਇੰਜਣ ਰੱਖੇ ਵੇ ਹੁੰਦੇ ਤਾਂ ਇੰਜਣ ਦੇ ਇੰਜਣ ਦੇ ਪਟਾ ਲੱਗ ਕੇ ਆਪਣਾ ਪੁਲ਼ੀ 'ਤੇ ਪਟਾ ਲੱਗ ਕੇ ਇੰਜਣ ਦਾ ਤਾਂ ਉਸਦੇ ਨਾਲ ਪਾਣੀ ਖਿੱਚਿਆ ਜਾਂਦਾ ਹੈ ਟਿਊਬਵੈੱਲ ਚੱਲ ਪੈਂਦਾ ਸਾਡੇ ਪਿੰਡ ਦੇ ਵਿੱਚ ਇੱਕ ਕ੍ਰਿਸ਼ਨਾ ਮੰਦਰ ਹੈ ਕ੍ਰਿਸ਼ਨਾ ਮੰਦਰ ਦੇ ਕੋਲ ਮਤਲਬ ਇਕ ਵੱਡਾ ਬਹੁਤ ਵੱਡਾ ਖੂਹ ਹੈ ਪੁਰਾਣਾ ਜਿਸ ਤੋਂ ਮਤਲਬ ਹਰ ਇੱਕ ਕੋਈ ਮਤਲਬ ਪਾਣੀ ਵਰਤਦਾ ਹੈ ਉਹ ਪਾਣੀ ਬਹੁਤ ਸਾਫ ਹੈ ਪਾਣੀ ਪੀਣ ਦੇ ਲਾਇਕ ਵੀ ਹੈ